ਦੀਵਾਲੀ ਹਿੰਦੂ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਸ ਦਿਨ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇਕੱਠੇ ਹੋ ਕੇ ਮਨਾਉਂਦੇ ਹਨ ਇਸ ਦਿਨ ਸ਼ੀ ਸ਼੍ਰੀ ਰਾਮ ਚੰਦਰ ਜੀ ਮਾ ਜੀ ਦੇ ਚੌਦ੍ਹਾਂ ਸਾਲ ਦਾ ਬਨਵਾਸ ਕੱਟ ਕੇ ਆਏ ਸਨ ਅਤੇ ਉਹਨਾਂ ਦੀ ਖੁਸ਼ੀ ਦੇ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਅਤੇ ਸਿੱਖ ਪ ਸਿੱਖ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਬਵੰਜਾ ਰਾਜਿਆਂ ਨੂੰ ਜੇਲ 'ਚੋਂ ਰਿਹਾਅ ਕਰਵਾ ਕੇ ਦਰਬਾਰ ਸਾਹਿਬ ਆਏ ਸਨ ਅਤੇ ਸਿੱਖ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਇਹ ਦਿਵਾਲੀ ਜਿਹੜੀ ਹੈ ਉਹ ਸਾਡੇ ਹਿੰਦੂ ਸਿੱਖ ਧ ਧਰਮਾਂ ਦੇ ਨਾਲ ਸੰਬੰਧਿਤ ਹੈ ਅਤੇ ਇਹ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਹਰਿਮੰਦਰ ਸਾਹਿਬ ਵਿੱਚ ਹ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਮਨਾਈ ਜਾਂਦੀ ਹੈ ਹੋਲੀ ਹੋਲੀ ਵੀ ਇੱਕ ਸਾਡਾ ਰੰਗਾਂ ਦਾ ਤਿਉਹਾਰ ਹੈ ਜਿਹੜਾ ਕਿ ਅਸੀਂ ਅਸੀਂ ਮ ਪ ਮਨਾਉਂਦੇ ਹਾਂ ਇਸ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਹੋਲੀ ਮਨਾਉਂਦੇ ਹਨ ਏ ਅਤੇ ਹੋਲੀ ਵਿਰੰਦਾਵਨ ਵਿੱਚ ਵੀ ਮਨਾਈ ਜਾਂਦੀ ਹੈ ਅਤੇ ਇਹ ਬੜੇ ਹੀ ਪਿਆਰ ਭਾਵਿਕ ਨਾਲ ਮਨਾਈ ਜਾਂਦੀ ਹੈ ਪੰਜਾਬ ਵਿੱਚ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਹੱਲੇ ਦੇ ਤੌਰ 'ਤੇ ਮਨਾਈ ਜਾਂਦੀ ਹੈ ਧੰਨਵਾਦ